ਕਿਸਾਨਾਂ ਲਈ ਭਾਈਚਾਰਾ ਬਹੁਤ ਹੀ ਖੇਤੀਬਾੜੀ ਬਾਰੇ ਸਾਨੂੰ ਸੁਝਾਅ ਦਿੰਦੇ ਹਨ ਜਿਵੇਂ ਸ ਸਾਧਨਾਂ ਦੀ ਸਹੂਲਤਾਂ ਅਤੇ ਸੇ ਖੇਤੀ ਲਈ ਸਿੰਚਾਈ ਸਾਧਨ ਹੋਰ ਵੀ ਜੋ ਵੀ ਕੀਟਨਾਸ਼ਕ ਦਵਾਈਆਂ ਵੀ ਉਹਨਾਂ ਨੂੰ ਕਿਵੇਂ ਉਗਾਉਣਾ ਵਾ ਕਿਵੇਂ ਉਹਨਾਂ ਦੀ ਵਡਾਈ ਕਰਨੀ ਹੈ ਕਿਵੇਂ ਉਹਨਾਂ ਦੀ ਸਾਂਭ ਸੰਭਾਲ ਕਰਨੀ ਆ ਕਿ ਸਮੇਂ ਸਮੇਂ ਸਿਰ ਸਾਨੂੰ ਹਰੇਕ ਹੀ ਸਹੂਲਤ ਜਿਹੜੀ ਆ ਉਹ ਦਿੰਦੇ ਰਹਿੰਦੇ ਹਨ ਅਤੇ ਉਹ ਸਾਡੀ ਖੇਤੀ ਖੇਤੀ ਕਰਨ ਵਿੱਚ ਬਹੁਤ ਹੀ ਜਿਹੜਾ ਭਾਈਚਾਰਾ ਕਿਸਾਨਾਂ ਦਾ ਭਾਈਚਾਰਾ ਬਹੁਤ ਹੀ ਸਹਾਇਤਾ ਕਰਦੇ ਹਨ ਵੀ ਉਹ ਹਰੇਕ ਸਮੇਂ ਸਮੇਂ 'ਚ ਇਹ ਸਾਨੂੰ ਉਹ ਦੱਸਦੇ ਰਹਿੰਦੇ ਹਨ ਵੀ ਕਿਵੇਂ ਕਿਹੜੇ ਸਮੇਂ ਇਹਨਾਂ ਨੂੰ ਪਾਣੀ ਦੀ ਸਹੂਲਤ ਦੇਣੀ ਆ ਕਿਹੜੇ ਸਮੇਂ ਸਪਰੇਅ ਕਰਨੀ ਆ ਕਿਹੜੇ ਟਾਈਮ 'ਤੇ ਇਹਨਾਂ ਨੂੰ ਵੱਢਣਾ ਵਾ ਕਿਹੜੇ ਟਾਈਮ 'ਤੇ ਬੀਜ ਕਰਨਾ ਵਾ ਕਿਹੜਾ ਮੌਸਮ ਇਹਨਾਂ ਲਈ ਸਹੀ ਆ ਕਿਹੜਾ ਮੌਸਮ ਇਹਨਾਂ ਲਈ ਨਹੀਂ ਸਹੀ ਉਹ ਹਨ ਹਮੇਸ਼ਾ ਹੀ ਸਾਡੀ ਸਹਾਇਤਾ ਕਰਦੇ ਨੇ ਉਹ ਹਰੇਕ ਚੀਜ਼ ਬਾਰੇ ਉਹ ਸਾਨੂੰ ਮਤਲਬ ਕਿ ਦੱਸਦੇ ਰਹਿੰਦੇ ਹਨ ਵੀ ਕਿਹੜੀ ਚੀਜ਼ ਇਹਨਾਂ ਲਈ ਸਹੀ ਹੈ ਖੇਤੀ ਲਈ ਸਹੀ ਆ ਕਿਹੜੀ ਚੀਜ਼ ਨਹੀਂ ਸਹੀ ਲਈ ਸਹੀ ਲਈ ਸਹੀ ਉਸ ਸਮੇਂ ਸਮੇਂ ਸਿਰ ਸਾਨੂੰ ਦੱਸਦੇ ਹੁੰਦੇ ਵੀ ਕਿਹੜੀ ਖਾਦ ਇਹਨਾਂ ਲਈ ਸਹੀ ਆ ਗੋਬਰ ਦੀ ਖਾਦ ਸਹੀ ਆ ਜਾਂ ਹੋਰ ਖਾਦਾਂ ਜਿਹੜੀਆਂ ਵਾ ਉਹ ਯੂਰੀਆ ਹੋਰ ਐਰਾ ਵਗੈਰਾ ਖਾਦਾਂ ਸਾਨੂੰ ਦੱਸਦੇ ਆ ਵੀ ਕਿਹੜੀ ਖੇਤੀ ਲਈ ਕਿਹੜੀ ਖਾਦ ਕਿਹੜੀ ਸਹੀ ਆ ਖੇਤੀਬਾੜੀ ਵਿੱਚ ਕਿਸਾਨਾਂ ਦਾ ਕਿਸਾਨੀ ਭਾਈਚਾਰੇ ਦਾ ਬਹੁਤ ਹੀ ਯੋਗਦਾਨ ਆ ਉਹ ਸਮੇਂ ਸਮੇਂ ਸਿਰ ਬਹੁਤ ਹੀ ਸਹਾਇਤਾ ਕਰਦਾ ਵਾ